ਜੀ ਹਾਂ ਸਾਡੇ ਵੀ ਖੇਤਰ ਵਿੱਚ ਇੱਕ ਵੈਟੀਨਰੀ ਡਾਕਟਰ ਹਨ ਉਹ ਬੜੇ ਚੰਗੇ ਅਤੇ ਬੜੇ ਨਰਮ ਦਿਲ ਇਨਸਾਨ ਸਨ ਉਹ ਕਦੇ ਵੀ ਕਿਸੇ ਵੀ ਜਾਨਵਰ ਦਾ ਇਲਾਜ ਕਰਨ ਤੋਂ ਇਨਕਾਰ ਨਹੀਂ ਕਰਦੇ ਚਾਹੇ ਕਿ ਕੋਈ ਵੀ ਸਮਾਂ ਕਿਉਂ ਨਾ ਹੋਵੇ ਉਹ ਹਮੇਸ਼ਾ ਹੀ ਜਾਨਵਰਾਂ ਨਾਲ ਬਹੁਤ ਪਿਆਰ ਕਰਦੇ ਹਨ ਅਤੇ ਉਹਨਾਂ ਦੇ ਦਿਲ ਵਿੱਚ ਵਸੇ ਹੋਏ ਹਨ ਜਾਨਵਰ ਵੀ ਉਹਨਾਂ ਦਾ ਬਹੁਤ ਕਰਦੇ ਹਨ ਅਤੇ ਉਹ ਜਾਨਵਰਾਂ ਦਾ ਬਹੁਤ ਕਰਦੇ ਹਨ ਮੇਰੇ ਕੋਲ ਵੀ ਇੱਕ ਜਾਨਵਰ ਹੈ ਜਿਸ ਦਾ ਖਿਆਲ ਮੈਂ ਹਮੇਸ਼ਾ ਰੱਖਦਾ ਹਾਂ ਮੈਂ ਆਪਣੇ ਜਾਨਵਰ ਦੀ ਹਰ ਮਹੀਨੇ ਤੋਂ ਮਹੀਨੇ ਜਾਂਚ ਉਹਨਾਂ ਕੋਲੋਂ ਹੀ ਜਾਂਚ ਕਰਵਾਉਂਦਾ ਹਾਂ ਅਤੇ ਉਹ ਉਹਨੂੰ ਤੰਦਰੁਸਤ ਰੱਖਣ ਲਈ ਬੜੇ ਸਾਰੇ ਟੀਕਾ ਟੀਕੇ ਦੱਸਦੇ ਨੇ ਅਤੇ ਬੜੀ ਸਾਰੀਆਂ ਦਵਾਈਆਂ ਦੱਸਦੇ ਹਨ ਤਾਂ ਕਿ ਉਹ ਬਿਮਾਰੀਆਂ ਤੋਂ ਦੂਰ ਰਹੇ ਅਤੇ ਆਪਣਾ ਸੁਖੀ ਜੀਵਨ ਜੀ ਸਕੇ ਅਤੇ ਇਸ ਦਾ ਖਰਚਾ ਬਹੁਤ ਜ਼ਿਆਦਾ ਖਰਚਾ ਆ ਜਾਂਦਾ ਹੈ ਕਿਉਂਕਿ ਜਾਨਵਰਾਂ ਦੀ ਦਵਾਈਆਂ ਸਸਤੀ ਨਹੀਂ ਬਹੁਤ ਮਹਿੰਗੀਆਂ ਆਉਂਦੀਆਂ ਹਨ ਕਿਉਂਕਿ ਇਹਨਾਂ ਨੂੰ ਬੜਾ ਪਿਆਰ ਕੀਤਾ ਜਾਂਦਾ ਹੈ ਅਤੇ ਇਹਨਾਂ ਦੀ ਤੰਦਰੁਸਤੀ ਲਈ ਲੋਕ ਬਹੁਤ ਪੈਸਾ ਖਰਚ ਦਿੰਦੇ ਹਨ ਤਾਂ ਕਰਕੇ ਇਹਨਾਂ ਦੀ ਦਵਾਈਆਂ ਬਹੁਤ ਮਹਿੰਗੀਆਂ ਆਉਂਦੀਆਂ ਹਨ ਪਰ ਛੱਡੋ ਕੋਈ ਗੱਲ ਨਹੀਂ ਇਹਨਾਂ ਦੀ ਤੰਦਰੁਸਤੀ ਵਿੱਚ ਹੀ ਸਭ ਦੀ ਤੰਦਰਸਤੀ ਹੈ ਮੇਰੇ ਵੈਟੀਨਰੀ ਡਾਕਟਰ ਜੀ ਹਮੇਸ਼ਾ ਹੀ ਸਾਨੂੰ ਜਾਨਵਰਾਂ ਨੂੰ ਕੀ ਦੇਣਾ ਚਾਹੀਦਾ ਹੈ ਅਤੇ ਕੀ ਨਹੀਂ ਉਹਨਾਂ ਦੀ ਸਿਹਤ ਕਿਸ ਖਾਣੇ ਨਾਲ ਬਣਦੀ ਹੈ ਅਤੇ ਕਿਸ ਖਾਣੇ ਨਾਲ ਉਹਨਾਂ ਦੀ ਸਿਹਤ ਖ਼ਰਾਬ ਹੋ ਜਾਂਦੀ ਹੈ ਇਹ ਸਾਨੂੰ ਹਰ ਵਾਰੀ ਸਮਝਾਉਂਦੇ ਰਹਿੰਦੇ ਹਨ ਅਤੇ ਮੇਰੇ ਵੈਟੀਨਰੀ ਡਾਕਟਰ ਹਮੇਸ਼ਾ ਹੀ ਜਾਨਵਰਾਂ ਦਾ ਬਹੁਤ ਹੀ ਪਿਆਰ ਨਾਲ ਸਲੂਕ ਕਰਦੇ ਨੇ ਅਤੇ ਉਹਨਾਂ ਦਾ ਹਮੇਸ਼ਾ ਹੀ ਖਿਆਲ ਰੱਖਦੇ ਨੇ